ਇੱਕ ਨਵੇਂ ਜੰਮੇ ਬੱਚੇ ਲਈ ਪੰਜਾਬ ਦੇ ਵਿੱਚ ਜੋ ਰਸਮਾਂ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਵਿੱਚੋਂ ਮੈਂ ਕੁਛ ਤਾਂ ਕੁਛ ਨੂੰ ਦੱਸਾਂਗੀ ਅਤੇ ਸਭ ਤੋਂ ਪਹਿਲਾਂ ਅਸੀਂ ਇੱਕ ਛੋਟੇ ਬੱਚੇ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਕੇ ਜਾਂਦੇ ਹਾਂ ਉਹਦੇ ਨਾਮਕਰਨ ਦੇ ਲਈ ਉੱਥੇ ਜਾ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਹੁਕਮਨਾਮਾ ਲਿਆ ਜਾਂਦਾ ਹੈ ਅਤੇ ਹੁਕਮਨਾਮੇ ਦੇ ਵਿੱਚ ਜੋ ਵੀ ਆਖਰੀ ਅੱਖਰ ਆਉਂਦਾ ਹੈ ਜਿਵੇਂ ਕਿ ਜੱਜਾ ਆ ਗਿਆ ਸੱਸਾ ਆ ਗਿਆ ਤਾਂ ਉਸ ਤੋਂ ਅਸੀਂ ਨਾਮ ਜਿਹੜਾ ਹੈ ਉੱਥੇ ਸੋਚ ਕੇ ਉਸ ਦਾ ਨਾਮ ਰੱਖਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਜਿਹੜਾ ਲੋਹੜੀ ਦਾ ਤਿਉਹਾਰ ਹੈ ਉਹ ਵੀ ਬੱਚੇ ਨਵ ਜੰਮੇ ਬੱਚੇ ਲਈ ਹੀ ਮਨਾਇਆ ਜਾਂਦਾ ਹੈ ਅਤੇ ਉਸ ਦੇ ਵਿੱਚ ਲੋਹੜੀ ਦੇ ਲੋਹੜੀ ਪਾਈ ਜਾਂਦੀ ਆ ਬੱਚ ਛੋਟੇ ਬੱਚਿਆਂ ਦੇ ਲਈ